ਹਾਂਜੀ ਮੈਂ ਫਲਿੱਪਕਾਡ ਤੋਂ ਬੈੱਡਸ਼ੀਟ ਮੰਗਵਾਈ ਸੀ ਜੀ ਬਹੁਤ ਅੱਛੀ ਬੈੱਡਸ਼ੀਟ ਹੈ ਜੀ ਅਤੇ ਬਾਹਰੋਂ ਵੀ ਇਹਦੀ ਪੈਕਿੰਗ ਹੀ ਬੜੀ ਜ਼ਬਰਦਸਤ ਸੀ ਜਦੋਂ ਮੈਂ ਖੋਲ੍ਹਿਆ ਤਾਂ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਈ ਤੁਹਾਡੇ ਸਟੀਚਿੰਗ ਹੈ ਜਿਹੜੀ ਇਹਦੀ ਬਹੁਤ ਜ਼ਬਰਦਸਤ ਹੈ ਅਤੇ ਜਦੋਂ ਬੈੱਡ 'ਤੇ ਵਿਛਾਈ ਤਾਂ ਬਹੁਤ ਵਧੀਆ ਲੱਗੀ ਕਿਸੇ ਤਰ੍ਹਾਂ ਦਾ ਕੋਈ ਵਲ ਨਹੀਂ ਸੀ ਅਤੇ ਅੱਗੇ ਤੋਂ ਵੀ ਮੈਂ ਹੋਰ ਤੁਆਨੂੰ ਔਡਰ ਕਰੂੰਗਾ ਫਲਿੱਪਕਾਡ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ